ਸਾਡੇ ਤਰਨ ਤਾਰਨ ਜ਼ਿਲ੍ਹੇ ਵਿੱਚ ਜਿਹੜੇ ਆ ਲੋਕ ਬਹੁਤ ਮਿਲ ਜੁਲ ਕੇ ਰਹਿੰਦੇ ਨੇ ਅਤੇ ਇੱਥੇ ਜਿਹੜੇ ਤਿਉਹਾਰ ਆ ਬੜੇ ਉਤਸ਼ਾਹ ਦੇ ਨਾਲ ਮਨਾਏ ਜਾਂਦੇ ਨੇ ਅਤੇ ਇੱਥੇ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਜ਼ਿਆਦਾ ਹੈ ਜਿਵੇਂ ਕਿ ਅਸੀਂ ਵਿਸ਼ਕਰਮਾ ਦਿਨ ਦੇ ਤਿਉਹਾਰ 'ਤੇ ਅਸੀਂ ਕੀ ਕਰਦੇ ਸਾਰੇ ਲੋਕ ਛੁੱਟੀ ਕਰਦੇ ਆ ਉਸ ਦਿਨ ਅਤੇ ਜਿਹੜੇ ਮਿਸਤਰੀ ਜਾਂ ਹੋਰ ਲੋਕ ਹੁੰਦੇ ਆ ਉਹ ਆਪਣੇ ਜਿਹੜੇ ਉਹਨਾਂ ਦੇ ਸੰਦ ਸਮਾਨ ਹੁੰਦੇ ਆ ਉਹਨਾਂ ਦੀ ਪੂਜਾ ਕਰਦੇ ਨੇ ਅਤੇ ਉਸ ਤੋਂ ਬਾਅਦ ਦੀਵਾਲੀ ਵਾਲੇ ਦਿਨ ਲੋਕ ਲਛਮੀ ਮਾਤਾ ਦੀ ਪੂਜਾ ਕਰਦੇ ਨੇ ਅਤੇ ਰਾਤ ਨੂੰ ਜਿਹੜਾ ਲੋਕ ਪਟਾਕੇ ਵੀ ਚਲਾਉਂਦੇ ਆ ਅਤੇ ਮਠਿਆਈਆਂ ਖਾਂਦੇ ਆ ਅਤੇ ਜਦੋਂ ਇੱਥੇ ਕੋਈ ਵੀ ਨਗਰ ਕੀਰਤਨ ਜਦੋਂ ਮਨਾਇਆ ਜਾਂਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਨਾਨਕ ਦੇਵ ਜੀ ਦਾ ਕੋਈ ਜਨਮ ਦਿਹਾੜਾ ਹੁੰਦਾ ਵਾ ਅਤੇ ਉਦੋਂ ਲੋਕ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਅਤੇ ਉਹ ਨਗਰ ਕੀਰਤਨ ਪਿੰਡ ਪਿੰਡ ਵਿੱਚ ਨਗਰ ਕੀਰਤਨ ਕੱਢਦੇ ਨੇ ਅਤੇ ਲੋਹੜੀ ਦੇ ਤਿਉਹਾਰ 'ਤੇ ਜਿਵੇਂ ਕਿ ਲੋਕ ਪਤੰਗਾਂ ਉਡਾਉਂਦੇ ਨੇ ਕੁੜੀਆਂ ਘਰਾਂ ਘਰਾਂ ਵਿੱਚ ਲੋਹੜੀ ਮੰਗਣ ਜਾਂਦੀਆਂ ਨੇ ਅਤੇ ਫੁੱਲੇ ਮੂੰਗਫਲੀ ਰਿਓੜੀਆਂ ਖਾਧੀਆਂ ਜਾਂਦੀਆਂ ਨੇ ਅਤੇ ਲੋਕ ਜਿਹਨਾਂ ਦੇ ਘਰੇ ਲੋਹੜੀ ਹੁੰਦੀ ਉਹ ਵੰਡ ਲੋਹੜੀ ਵੰਡਦੇ ਆ ਅਤੇ ਉਸ ਤੋਂ ਬਾਅਦ ਕਿ ਜਿਵੇਂ ਇੱਥੇ ਹੋਰ ਵੀ ਬਹੁਤ ਸਾਰੇ ਤਿਉਹਾਰ ਨੇ ਅਤੇ ਉਹ ਸਾਰੇ ਰਲ ਮਿਲ ਕੇ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਏ ਜਾਂਦੇ ਨੇ ਇਸ ਤੋਂ ਇਹ ਪਤਾ ਲੱਗਦਾ ਕਿ ਸਾਡਾ ਜਿਹੜਾ ਤਰਨ ਤਾਰਨ ਜ਼ਿਲ੍ਹੇ ਦਾ ਭਾਈਚਾਰਾ ਹੈ ਉਹ ਬਹੁਤ ਹੀ ਕਾਇਮ ਹੈ ਅਤੇ ਲੋਕ ਇੱਥੇ ਬਹੁਤ ਆਪਸੀ ਮਿਲਜੁਲ ਕੇ ਰਹਿੰਦੇ ਨੇ